ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਬਲਵੰਤ ਰਾਜ ਬੋਲ ਰਿਹਾ ਜੀ ਤੁਹਾਡੇ ਮੈਂ ਗ ਗੁਆਂਢ ਵਿੱਚ ਨਵਾਂ ਮਕਾਨ ਲਿਆ ਅਤੇ ਮੈਂ ਕਹਿੰਦਾ ਕਿ ਡੇਅਰੀ ਦੇ ਕੋਈ ਪ੍ਰੋਡਕਟ ਅ ਡੇਅਰੀ ਦੇ ਪ੍ਰੋਡਕਟ ਵਗੈਰਾ ਮੈਂ ਜਾਣਨਾ ਚਾਹੁੰਦਾ ਕਿੱਥੋਂ ਸਸਤੇ ਅਤੇ ਵਧੀਆ ਮਿਲਦੇ ਨੇ ਅੱਛਾ ਅੱਛਾ ਹਾਂਜੀ ਹਾਂਜੀ ਬਾਬਾ ਡੇਅਰੀ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਹੈ ਜੀ ਮਿਹਰਬਾਨੀ ਮਹਾਰਾਜ ਠੀਕ ਹੈ

ਠੀਕ ਹੈ ਜੀ ਧੰਨਵਾਦ ਜੀ